ਗਿਆਰ੍ਹਾਂ ਨਵੰਬਰ ਉੱਨੀ ਸੌ ਪੈਂਹਠ ਬਾਈ ਅਗਸਤ ਉੱਨੀ ਸੌ ਨੜਿਨਵੇਂ ਇਕੱਤੀ ਅਕਤੂਬਰ ਦੋ ਹਜ਼ਾਰ ਬਾਰ੍ਹਾਂ ਇੱਕ ਜਨਵਰੀ ਦੋ ਹਜ਼ਾਰ ਵੀਹ ਪੰਦਰ੍ਹਾਂ ਅਕ ਸਤੰਬਰ ਦੋ ਹਜ਼ਾਰ ਤੇਰ੍ਹਾਂ